ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਏ ਕਿ ਕੀੜੇ ਮਕੌੜੇ ਕੁਦਰਤ ਦਾ ਇੱਕ ਅਨਿੱਖੜਵਾਂ ਅੰਗ ਹਨ ਜੋ ਕਿ ਮੌਸਮ ਦੇ ਹਿਸਾਬ ਨਾਲ਼ ਹਰ ਘਰ ਹਰ ਜਗ੍ਹਾ ਦੇਖਣ ਨੂੰ ਮਿਲਦੇ ਨੇ ਇਹਨਾਂ ਵਿੱਚੋਂ ਜੇਕਰ ਅਸੀਂ ਗੱਲ ਕਰੀਏ ਮਧੂਮੱਖੀ ਜਾਂ ਭਰਿੰਡ ਦੀ ਤਾਂ ਅਕਸਰ ਹੀ ਲੋਕਾਂ ਨੂੰ ਕੱਟ ਦਿੰਦੇ ਨੇ ਉਹ ਵੀ ਆਪਣੇ ਬਚਾ ਲਈ ਅਤੇ ਜਿਹਨਾਂ ਦੇ ਕੱਟਣ ਨਾਲ਼ ਕਾਫ਼ੀ ਸਾਰੀ ਸੋਜ਼ ਹੋ ਜਾਂਦੀ ਹੈ ਜਾਂ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਅਤੇ ਇਹਨਾਂ ਦੇ ਘਰੇਲੂ ਉਪਾਅ ਤਾਂ ਬਹੁਤ ਹਨ ਪਰ ਜ਼ਿਆਦਾਤਰ ਪੁਰਾਣੇ ਲੋਕ ਪਹਿਲਾਂ ਕੀ ਕਰਦੇ ਸੀਗੇ ਪਾਣੀ ਨੂੰ ਗਰਮ ਕਰਕੇ ਉਹਦੇ ਵਿੱਚ ਨਮਕ ਪਾ ਕੇ ਤੇਲ ਪਾ ਕੇ ਉਹਦੀ ਕਟੋਰ ਕੀਤੀ ਜਾਂਦੀ ਸੀ ਉਹਦੇ ਤੋਂ ਸੋਜ਼ ਘੱਟ ਕਰਨ ਲਈ ਉਹਤੋਂ ਰਾਹਤ ਪਾਈ ਜਾਂਦੀ ਸੀ ਅਤੇ ਜ਼ਿਆਦਾਤਰ ਲੋਕ ਨਿੰਮ ਦੇ ਪੱਤਿਆਂ ਦੀ ਕਟੋਰ ਕਰਦੇ ਨੇ ਅਤੇ ਹੋਰ ਵੀ ਬਹੁਤ ਸਾਰੇ ਉਹ ਮਤਲਬ ਕਿ ਆਪਣੇ ਬਚਾ ਲਈ ਘਰੇਲੂ ਨੁਸਖੇ ਅਪਣਾਉਂਦੇ ਨੇ ਉਹਨਾਂ ਵਿੱਚੋਂ ਜਿਹੜਾ ਕਿ ਸਭ ਤੋਂ ਜ਼ਿਆਦਾ ਘਰੇਲੂ ਨੁਸਖੇ ਏ ਉਹ ਨਿੰਮ ਦੀ ਕਟੋਰ ਨਿੰਮ ਦੇ ਪਾਣੀ ਦੀ ਕਟੋਰ ਕਰਨੀ ਜਿਹੜੀ ਹੈ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਜੇਕਰ ਨਿੰਮ ਨੂੰ ਵੇਖੀਏ ਤਾਂ ਨਿੰਮ ਦੇ ਪੱਤੇ ਖਾਣ ਨਾਲ਼ ਵੀ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਮੈਨੂੰ ਅਜੇ ਤੱਕ ਯਾਦ ਹੈ ਕਿ ਮੈਂ ਜਦ ਵੀ ਆਪਣੇ ਨਾਨਕੇ ਘਰ ਗਈ ਸੀ ਤਾਂ ਉਦੋਂ ਮੈਨੂੰ ਇੱਕ ਵਾਰ ਭਰਿੰਡ ਨੇ ਕੱਟ ਲਿਆ ਸੀ ਜਿਸ ਕਰਕੇ ਮੇਰੇ ਨਾਨੀ ਜੀ ਨੇ ਮੈਨੂੰ ਨਿੰਮ ਦੇ ਪੱਤੇ ਖਾਣ ਲਈ ਦਿੱਤੇ ਜਿਹੜੇ ਖਾਣ 'ਚ ਤਾਂ ਥੋੜ੍ਹੇ ਕੌੜੇ ਸੀ ਪਰ ਉਹਨਾਂ ਨੇ ਮੈਨੂੰ ਬਹੁਤ ਹੀ ਆਰਾਮ ਦਿੱਤਾ ਪਰ ਇਹ ਛੋਟੇ ਛੋਟੇ ਨੁਸਖੇ ਜਿਹੜੇ ਆ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਜਦ ਵੀ ਕਿਤੇ ਭਰਿੰਡ ਜਾਂ ਮਧੂਮੱਖੀ ਡੰਗਦੀ ਹੈ ਤਾਂ ਅਸੀਂ ਉਹਦੇ ਉੱਪਰ ਅਕਸਰ ਲੋਹਾ ਰਗੜਦੇ ਆਂ ਕਿਉਂਕਿ ਲੋਹਾ ਰਗੜਣ ਨਾਲ਼ ਵੀ ਇਹ ਜਿਹੜੀ ਸੋਜ਼ ਐ ਇਹ ਘੱਟ ਹੁੰਦੀ ਹੈ ਅਤੇ ਉਸ ਤੋਂ ਇਲਾਵਾ ਅੱਜ ਗੱਲ ਜੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਦਵਾਈਆਂ ਚੱਲ ਗਈਆਂ ਹਨ ਅਤੇ ਜੇਕਰ ਜੇਕਰ ਸਾਨੂੰ ਜ਼ਿਆਦਾ ਉਹ ਦਿੱਕਤ ਹੁੰਦੀ ਹੈ ਨਾ ਤਾਂ ਅਸੀਂ ਅੱਜ ਕੱਲ੍ਹ ਡੋਕਟਰ ਦੀ ਸਲਾਹ ਵੀ ਲੈ ਲੈ ਲੈਂਦੇ ਹਾਂ ਕਿ ਅੱਜ ਕੱਲ੍ਹ ਬਹੁਤ ਸਾਰੇ ਇੰਜੈਕਸ਼ਨ ਨੇ ਜੋ ਇਹਨਾਂ ਚੀਜ਼ਾਂ ਤੋਂ ਸਾਨੂੰ ਰਾਹਤ ਦਵਾਉਂਦੇ ਨੇ ਅਤੇ ਬਹੁਤ ਸਾਰੀਆਂ ਸਭ ਤੋਂ ਪਹਿਲਾਂ ਕਹੀਏ ਤਾਂ ਬਹੁਤ ਸਾਰੀਆਂ ਜਿਹੜੀਆਂ ਘਰੇਲੂ ਹੀ ਦਵਾਈਆਂ ਜੋ ਪਹਿਲਾਂ ਵਰਤੀਆਂ ਜਾਂਦੀਆਂ ਸੀ ਸਭ ਤੋਂ ਜ਼ਿਆਦਾ ਉਹੀ ਲਾਭਦਾਇਕ ਹਨ ਪਰ ਫਿਰ ਵੀ ਮੈਂ ਇਹੀ ਕਹਿਣਾ ਚਾਹੁੰਦੀ ਕਿ ਜੇਕਰ ਸਾਨੂੰ ਇਸ ਚੀਜ਼ ਦੀ ਜਿਆਦਾ ਪ੍ਰੋਬਲਮ ਹੈ ਨਾ ਜਾਂ ਸੋਜ਼ ਜ਼ਿਆਦਾ ਜਾਂ ਕਿੱਦਾਂ ਵੀ ਕਾਫ਼ੀ ਦਿਨ ਹੋ ਗਏ ਨੇ ਇਸ ਚੀਜ਼ ਨੂੰ ਲੈ ਕੇ ਤੇ ਸਾਨੂੰ ਡੋਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਅਸੀਂ ਮਤਲਬ ਕਿ ਆਪਣਾ ਬਚਾ ਕਰ ਸਕਦੇ ਹਾਂ ਸੋ ਇਹ ਸਾਰੇ ਘਰੇਲੂ ਉਪਾਅ ਜਿਹੜੇ ਇਹਨਾਂ ਸਾਰੇ ਸਾਨੂੰ ਜ਼ਹਿਰੀਲੇ ਕੀੜੇ ਮਕੌੜਿਆਂ ਤੋਂ ਬਚਾਅ ਕਰ ਸਕਦੇ ਹਨ ਜਿਨ੍ਹਾਂ ਵਿੱਚ ਨਿੰਮ ਦੀ ਕਟੋਰ ਜਾਂ ਨਿੰਮ ਦੇ ਪੱਤੇ ਸਭ ਤੋਂ ਮਹੱਤਵਪੂਰਨ ਹਨ